ਹੈਲੋ ਹਾਂਜੀ ਐਕਸਿਨ ਸਾਹਿਬ ਮੈਂ ਬੋਲ ਰਹੀ ਹਾਂ ਗਲੀ ਨੰਬਰ ਪੰਜ ਤੋਂ ਹਾਂਜੀ ਆਪਣੇ ਏਰੀਏ ਦੀ ਗਲੀ ਨੰਬਰ ਪੰਜ ਤੋਂ ਬੋਲ ਰਹੀ ਹਾਂ ਅਤੇ ਸਾਰਾ ਸਾਡਾ ਨਾ ਬਿਜਲੀ ਦਾ ਬਿੱਲ ਆਇਆ ਸੀ ਅਤੇ ਮੈਂ ਤਾਂ ਘਰ 'ਚ ਇਕੱਲੇ ਰਹਿੰਦੀ ਹਾਂ ਅਤੇ ਸਾਡੇ ਕੋਈ ਥਰੀ ਫੇਜ ਨਹੀਂ ਹੈਗਾ ਸਿੰਗਲ ਫੇਸ ਏ ਤਾਂ ਬਿਜਲੀ ਦਾ ਬਿੱਲ ਤਾਂ ਜੀ ਬਹੁਤ ਜ਼ਿਆਦਾ ਪੰਦਰ੍ਹਾਂ ਹਜ਼ਾਰ ਰੁਪਏ ਆਇਆ ਏ ਅਤੇ ਮੈਨੂੰ ਡਾਊਟ ਏ ਕਿ ਕੋਈ ਤਾਰਾਂ ਦੇ ਵਿੱਚ ਗੜਬੜ ਜਾਂ ਬਿਜਲੀ ਦੇ ਮੀਟਰ ਵਿੱਚ ਕੁਛ ਗੜਬੜ ਚੱਲ ਰਹੀ ਏ ਤਾਂ ਮੈਂ ਉਹਨੂੰ ਚੈੱਕ ਕਰਵਾਉਣਾ ਚਾਹੁੰਦੀ ਹਾਂ ਅਤੇ ਤੁਸੀਂ ਦੱਸੋ ਜੀ ਕਿੱਥੇ ਅਪਲਾਈ ਕਰਨਾ ਹੈ ਅਤੇ ਜਾਂ ਕਿਸੇ ਇਲੈਕਟਰੀਸ਼ੀਅਨ ਨੂੰ ਭੇਜ ਦਿਓ ਜਿਸ ਦੇ ਨਾਲ ਉਹ ਸਾਰੀਆਂ ਤਾਰਾਂ ਅਤੇ ਮੀਟਰ ਚੈੱਕ ਕਰ ਜਾਵੇ ਨਹੀਂ ਜੀ ਮੈਂ ਇਨ੍ਹਾਂ ਸਾਰਾ ਬਿੱਲ ਨਹੀਂ ਆ ਸਕਦਾ ਕਿਉਂਕਿ ਮੇਰੇ ਪਿਛਲੇ ਬਿੱਲਾਂ ਨੂੰ ਜੇ ਚੈੱਕ ਕਰੀਏ ਤਾਂ ਮੇਰਾ ਐਵਰੇਜ ਬਿੱਲ ਜਿਹੜਾ ਹੈਗਾ ਦੋ ਕੁ ਹਜ਼ਾਰ ਰੁਪਏ ਮਹੀਨਾ ਆਉਂਦਾ ਏ ਅ ਜਿਹੜਾ ਕਿ ਹੁਣ ਪੰਦਰ੍ਹਾਂ ਹਜ਼ਾਰ ਰੁਪਏ ਮਹੀਨਾ ਆ ਗਿਆ ਏ ਅਤੇ ਜੇ ਤਾਰਾਂ ਠੀਕ ਨੇ ਜਾਂ ਮੀਟਰ ਵਿੱਚ ਕੋਈ ਗੜਬੜ ਹੈਗੀ ਏ ਜਾਂ ਉਹ ਖ਼ਰਾਬ ਨੇ ਤਾਂ ਪਲੀਜ਼ ਉਹਨਾਂ ਨੂੰ ਇਲੈਕਟਰੀਸ਼ੀਅਨ ਨੂੰ ਭੇਜ ਕੇ ਠੀਕ ਕਰਵਾਇਆ ਜਾਵੇ ਚਾਹੋ ਤਾਂ ਮੀਟਰ ਬਦਲਿਆ ਜਾਵੇ